ਮੈਂ ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਜੋ ਕੀ ਭੰਗੜੇ ਤੇ ਕੁਝ ਵਿਚਾਰ ਤੁਹਾਡੇ ਨਾਲ ਹੋ ਸਾਂਝੀ ਕਰਨਾ ਚਾਹੁੰਦਾ ਜਿਸ ਦੇ ਵਿੱਚ ਮੇਰਾ ਸਭ ਤੋਂ ਪਹਿਲਾ ਵਿਚਾਰ ਕੀ ਤੁਸੀਂ ਭੰਗੜੇ ਦੀ ਮਹੱਤਤਾ ਬਾਰੇ ਦੱਸ ਸਕਦੇ ਹੋ ਹਾਂਜੀ ਪੰਜਾਬ ਵਿੱਚ ਭੰਗੜਾ ਪੰਜਾਬ ਦਾ ਇੱਕ ਪੁਰਾਣਾ ਪ੍ਰਚਿਲਿਤ ਨਾਚ ਹੈ ਜਿਸ ਦੇ ਵਿੱਚ ਗੱਭਰੂ ਰੰਗ ਬਰੰਗੇ ਕੁੜਤੇ ਪਜਾਮੇ ਪਾ ਕੇ ਲਾਚੇ ਬੰਨ ਕੇ ਪੱਗਾਂ ਬੰਨ ਕੇ ਨਾਚ ਨੱਚਦੇ ਹਨ ਉਹ ਨਾਚ ਢੋਲ ਤੇ ਬੋਲੀਆ ਤੇ ਆਦੀ ਤੇ ਪਾਇਆ ਜਾਂਦਾ ਹੈ ਜਿਸ ਵਿੱਚ ਗੱਭਰੂ ਹਵਾ ਵਿੱਚ ਆਪਣੇ ਹੱਥ ਲਹਿਰਾ ਕੇ ਆਪਣੀ ਖੁਸ਼ੀ ਅਤੇ ਚਿਹਰੇ ਦੀ ਮੁਸਕਾਨ ਨੂੰ ਦਰਸ਼ਾਉਂਦੇ ਹਨ ਇਹ ਨਾਚ ਸਿਰਫ ਪੰਜਾਬ ਵਿੱਚ ਨਹੀਂ ਪੰਜਾਬ ਤੋਂ ਬਾਹਰ ਵੀ ਮਨਾਇਆ ਜਾਂਦਾ ਹੈ ਭਾਵ ਕੀ ਜਿੱਥੇ ਪੰਜਾਬੀ ਜਾਂਦੇ ਹਨ ਉਹ ਉੱਥੇ ਆਪਣੇ ਇਸ ਭੰਗੜੇ ਦੇ ਨਾਚ ਨੂੰ ਨੱਚ ਕੇ ਮਨਾਉਂਦੇ ਹਨ ਅਤੇ ਉਹਨਾਂ ਦੇ ਮਨਾਉਣ ਦੇ ਸਾਰਿਆਂ ਦੇ ਤਰੀਕੇ ਹੀ ਆਪਣੇ ਅਲੱਗ ਅਲੱਗ ਹੁੰਦੇ ਹਨ ਭਾਵ ਕੋਈ ਢੋਲ ਤੇ ਨੱਚਦੇ ਹਨ ਕਈ ਸੰਗੀਤ ਤੇ ਨੱਚਦੇ ਹਨ ਅਤੇ ਕਈ ਬੋਲੀਆਂ ਤੇ ਨੱਚਦੇ ਹਨ ਤੇ ਉਹਨਾਂ ਦੇ ਜਿਹੜੇ ਪਹਿਰਾਵੇ ਵੀ ਆਪਣੇ ਅਲੱਗ ਅਲੱਗ ਹੁੰਦੇ ਹਨ ਭਾਵ ਕੀ ਕੁੜਤੇ ਪਜਾਮੇ ਕੁੜਤੇ ਪਜਾਮੇ ਦੇ ਰੰਗ ਲਾਚਿਆਂ ਦੇ ਰੰਗ ਪੱਗਾਂ ਦੇ ਰੰਗ ਉਹਨਾਂ ਦੇ ਢੰਗ ਅਤੇ ਉਹਨਾਂ ਦੇ ਜਿਹੜੇ ਗਹਿਣੇ ਭੰਗੜੇ ਨਾਚ ਵਿੱਚ ਪਹਿਨਣ ਵਾਲੇ ਜਿਹੜੇ ਗਹਿਣੇ ਪੰਜਾਬੀਆਂ ਲਈ ਉਹ ਹਨ ਕੈਂਠੇ ਤਬੀਤੜੀਆਂ ਆਦਿ ਪਹਿਣ ਕੇ ਉਹ ਜਿਹੜਾ ਭੰਗੜਾ ਨਾਚ ਨੱਚਦੇ ਹਨ ਭੰਗੜਾ ਨਾਚ ਸਿਰਫ ਪੰਜਾਬ ਚ ਨਹੀਂ ਪੰਜਾਬ ਤੋਂ ਬਾਹਰ ਵੀ ਮਨਾਇਆ ਜਾਂਦਾ ਹੈ ਭਾਵ ਕਿ ਜਿੱਥੇ ਪੰਜਾਬੀ ਜਾਂਦੇ ਹਨ ਉਥੇ ਆਪਣਾ ਇਹ ਇਕੱਠੇ ਹੋ ਕੇ ਨਾਚ ਨੱਚਦੇ ਹਨ ਤੇ ਆਪਣੀ ਖੁਸ਼ੀ ਨੂੰ ਪ੍ਰਗਟਾਉਣ ਦੇ ਹਨ ਅਤੇ ਆਪਣੇ ਇਸ ਨਾਚ ਨੂੰ ਪ੍ਰਸਿੱਧ ਕਰਕੇ ਉਸ ਨੂੰ ਅਗਲੀ ਪੀੜੀ ਨੂੰ ਸੌਪ ਦਿੰਦੇ ਹਨ